ਕਾਨੂੰਨੀ ਸਹਾਇਤਾ ਤੋਂ ਬਿਨਾਂ ਪਿੰਡ ਵਾਸੀ ਜਾਇਦਾਦ ਦੀਆਂ ਹੱਦਾਂ ਅਤੇ ਜ਼ਮੀਨੀ ਵਿਵਾਦਾਂ ਦੇ ਮੁੱਦਿਆਂ ਨੂੰ ਬਹੁਤ ਹੀ ਸਿਆਣਪ ਨਾਲ ਨਜਿੱਠਦੇ ਹਨ ਵੈਸੇ ਤਾਂ ਹੁਣ ਕਾਨੂੰਨੀ ਸਹਾਇਤਾ ਹਰ ਪਿੰਡ ਪਿੰਡ ਵਿੱਚ ਪਹੁੰਚ ਚੁੱਕੀ ਹੈ ਪਰ ਅਗਰ ਜਦੋਂ ਪਹਿਲਾਂ ਨਹੀਂ ਹੁੰਦੀ ਸੀ ਤਾਂ ਪਿੰਡ ਵਿੱਚ ਇਹਨਾਂ ਚੀਜ਼ਾਂ ਲਈ ਪੰਚਾਇਤ ਦੀ ਸਹਾਇਤਾ ਲੈਣੀ ਪੈਂਦੀ ਸੀ ਅਤੇ ਪੰਚਾਇਤ ਵੀ ਇਹਨੂੰ ਬਹੁਤ ਹੀ ਤਰੀਕਿਆਂ ਦੇ ਨਾਲ ਬਹੁਤ ਹੀ ਸਿਆਣਪ ਦੇ ਨਾਲ ਇਸ ਮੁੱਦਿਆਂ ਨੂੰ ਅ ਪੂਰੀ ਤਰ੍ਹਾਂ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਜਾਂ ਖ਼ਤਮ ਕਰ ਦਿੰਦੀ ਹੁੰਦੀ ਸੀ ਜਿਵੇਂ ਇੱਕ ਚੀਜ਼ ਉਹ ਕਰਦੇ ਸੀਗੇ ਪੰਚਾਇਤ ਮੈਡੀਏਸ਼ਨ ਪਿੰਡ ਦੇ ਪੰਚਾਇਤ ਦੀ ਜਿਹੜੀ ਕਮੇਟੀ ਸੀ ਉਹ ਦੋਵਾਂ ਧਿਰਾਂ ਦੇ ਵਿਵਾਦਾਂ ਨੂੰ ਸੁਣਦੀ ਸੀ ਅਤੇ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਉਹਨਾਂ ਦੀਆਂ ਕੁਛ ਸ਼ਰਤਾਂ ਨੂੰ ਮੰਨ ਕੇ ਸਹਿਮਤੀ ਨਾਲ ਜ਼ਮੀਨੀ ਕਾਰਵਾਈਆਂ ਕਰਦੀਆਂ ਸਨ ਅਤੇ ਕਈ ਵਾਰੀ ਉਹਨਾਂ ਨੂੰ ਦੂਸ ਇਹਦੇ 'ਚ ਆ ਜਾਂਦਾ ਦੂਸਰਾ ਕਿ ਪੰ ਰਿਵਾਜ਼ਾਂ ਅਤੇ ਪੁਰਾਣੇ ਦਸਤਾਵੇਜ਼ ਪਿੰਡ ਵਾਸੀ ਦੀਆਂ ਜੋ ਵੀ ਉਸ ਜ਼ਮੀਨ ਜਾਇਦਾਦ ਦੀਆਂ ਕੁਛ ਪੁਰਾਣੀਆਂ ਦਸਤਾਵੇਜ਼ਾਂ ਨੂੰ ਉਸ ਦੇਖਦੀਆਂ ਸੀਗੀਆਂ ਅਤੇ ਉਸ ਉਹਨਾਂ ਨੂੰ ਦੇਖ ਕੇ ਫੈਸਲੇ ਲਿਤੇ ਜਾਂਦੇ ਸਨ ਕਈ ਵਾਰੀ ਗਵਾਹੀਆਂ ਅਤੇ ਸਮਝੌਤਾ ਪੁਰਾਣੇ ਗਵਾਹਾਂ ਦੀ ਗਵਾਹੀ ਲੈਣੀ ਅਤੇ ਆਪਸੀ ਬੈਠਕ ਰਾਹੀਂ ਸਮਝੌਤਾ ਕਰਨ ਵਾਲੀ ਇੱਕ ਤਰੀਕਾ ਹੁੰਦਾ ਸੀ ਅਤੇ ਜ਼ਮੀਨਾਂ ਦੀਆਂ ਉਹ ਫਰਦਾਂ ਕਢਵਾਉਣ ਵਾਸਤੇ ਪਟਵਾਰੀ ਅਤੇ ਕਾਨੂੰਗੋ ਦੀ ਮਦਦ ਲੈਂਦੇ ਹੁੰਦੇ ਸੀ ਅਤੇ ਅਤੇ ਹੋਰ ਵੀ ਬਹੁਤ ਤਰੀਕੇ ਸਨ ਜਿਹਨਾਂ ਨਾਲ ਉਹ ਇਨ੍ਹਾਂ ਜ਼ਮੀਨੀ ਜਾਇਦਾਦ ਦੀਆਂ ਵਿਵਾਦਾਂ ਨੂੰ ਖ਼ਤਮ ਕਰਦੇ ਸਨ